ਭਾਰ ਵਧਾਉਣ ਲਈ ਸਾਨੂੰ ਸਰਦੀਆਂ ਵਿੱਚ ਬਦਾਮ ਗਜਰੇਲਾ ਖੋਆ ਅਖਰੋਟ ਕਿਸ਼ਮਿਸ਼ ਮਗਜ਼ ਛੁਆਰੇ ਖਾਣੇ ਚਾਹੀਦੇ ਹਨ ਕਿਉਂਕਿ ਜ਼ਿਆਦਾਤਰ ਇਸਨੂੰ ਗਰਮ ਸਿਆਲਾਂ ਵਿੱਚ ਹੀ ਖਾਧਾ ਜਾਂਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਚੀਜ਼ਾਂ ਹੁੰਦੀਆਂ ਹਨ ਤਾਂ ਇਹਨਾਂ ਨੂੰ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਗਜਰੇਲਾ ਅਸੀਂ ਗਾਜਰਾਂ ਨੂੰ ਰਗੜ ਕੇ ਐਂਡ ਦੁੱਧ ਨੂੰ ਖੋਆ ਬਣਾ ਕੇ ਵਿੱਚ ਪਾ ਕੇ ਮਿਕਸ ਕਰਕੇ ਵਿੱਚ ਮ ਵਿੱਚ ਬਦਾਮ ਵਗੈਰਾ ਕਿਸ਼ਮਿਸ਼ ਵਗੈਰਾ ਪਾ ਕੇ ਅਸੀਂ ਤਿਆਰ ਕਰਦੇ ਹਾਂ ਖੋਆ ਜੋ ਕਿ ਸਾਨੂੰ ਪਹਿਲਾਂ ਦੁੱਧ ਰੱਖਣਾ ਪੈਂਦਾ ਹੈ ਉਸ ਵਿੱਚ ਉਸ ਨੂੰ ਤਿੰਨ ਚਾਰ ਘੰਟੇ ਰਾੜਨਾ ਪੈਂਦਾ ਹੈ ਜਿਸ ਦਾ ਖੋਆ ਤਿਆਰ ਹੁੰਦਾ ਹੈ ਫਿਰ ਉਸ ਵਿੱਚ ਬਦਾਮ ਛਵਾਰੇ ਕਿਸ਼ਮਿਸ਼ ਮਗਜ਼ ਵਗੈਰਾ ਆਦਿ ਰਗੜ ਕੇ ਪਾਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਅਸੀਂ ਸਰਦੀਆਂ ਵਿੱਚ ਖਾ ਸਕਦੇ ਹਾਂ ਅਤੇ ਜਿਸ ਨਾਲ ਸਾਡਾ ਭਾਰ ਵੱਧ ਸਕਦਾ ਹੈ ਗਰਮੀਆਂ ਵਿੱਚ ਸਾਨੂੰ ਜ਼ਿਆਦਾਤਰ ਜੂਸ ਵਗੈਰਾ ਆਦਿ ਦਾ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਬਨਾਨਾ ਸ਼ੇਕ ਮੈਂਗੋ ਸ਼ੇਕ ਆਦਿ ਹੋ ਗਿਆ ਅਤੇ ਹਰੀਆਂ ਸਬਜ਼ੀਆਂ ਦਾ ਵੀ ਜ਼ਿਆਦਾ ਯੂਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਜ਼ਿਆਦਾ ਭਾਰ ਵੱਧਦਾ ਹੈ ਅਤੇ ਸਾਨੂੰ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੋਟੀ ਪਾਣੀ ਆਦਿ ਖਾਣਾ ਚਾਹੀਦਾ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਨਾਲ ਸਾਡਾ ਬਹੁਤ ਜ਼ਿਆਦਾ ਭਾਰ ਵੱਧਦਾ ਹੈ ਸੋ ਸਾਨੂੰ ਤਲੀਆਂ ਚੀਜ਼ਾਂ ਦਾ ਵੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਸਾਡਾ ਭਾਰ ਜਲਦੀ ਤੋਂ ਜਲਦੀ ਵੱਧ ਸਕੇ